ਭੰਗੜਾ ਐਰੋਬਿਕਸ ਵੀ ਸੰਗੀਤ ਬਹੁਤ ਮੁੱਖ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਭੰਗੜਾ ਐਰੋਬਿਕਸ ਵਿੱਚ ਸੰਗੀਤ ਦੇ ਰਿਦਮ ਨੂੰ ਜੋੜ ਸਕਦੇ ਹਾਂ ਭੰਗੜਾ ਐਰੋਬਿਕਸ ਵਿੱਚ ਭੰਗੜੇ ਦੇ ਤੇਜ਼ ਅਤੇ ਉਤਸ਼ਾਹਪੂਰਨ ਗੀਤ ਵਰਤੇ ਜਾਂਦੇ ਹਨ ਸੰਗੀਤ ਦੇ ਰਿਦਮ ਨਾਲ ਜੁੜ ਕੇ ਨੱਚਦਿਆਂ ਲੱਗਦਾ ਹੈ ਕਿ ਲੜਕੀ ਖੇਡ ਰਹੀ ਹੈ ਇਹ ਗੀਤ ਅਤੇ ਸੰਗੀਤ ਕਿਸੇ ਖਾਸ ਪੰਜਾਬੀ ਸੰਗੀਤ ਲੋਕ ਸੰਗੀਤ ਜਾਂ ਫਿੱਕੇ ਰਿਦਮ 'ਤੇ ਅਧਾਰਿਤ ਹੋ ਸਕਦੇ ਹਨ ਸੰਗੀਤ ਦੇ ਨਾਲ ਜੁੜ ਕੇ ਮਜ਼ੇ ਅਤੇ ਮੋਟੀਵੇਸ਼ਨ ਮਹਿਸੂਸ ਕਰਦੇ ਹਾਂ ਕਸਰਤ ਕਰਨ ਵਾਲਿਆਂ ਨੂੰ ਵੀ ਇਸ ਰਿਦਮ ਨਾਲ ਉਤਸ਼ਾਹ ਅਤੇ ਊਰਜਾ ਮਿਲਦੀ ਹੈ ਭੰਗੜੇ ਐਰੋਬਿਕਸ ਦੇ ਰਿਦਮ ਨਾਲ ਕਸਰਤ ਅਤੇ ਵਰਕ ਆਊਟ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਉਤਸ਼ਾਹਿਤ ਮਹਿਸੂਸ ਕਰਦੇ ਹਾਂ